ਡਰਾਇੰਗ 'ਤੇ ਜੋ ਪੇਂਟਿੰਗ ਵਰਗੀਆਂ ਕਲਾਵਾਂ ਨੇ ਮੇਰੇ ਅਨੁਸਾਰ ਨਰਸਰੀ ਕਲਾਸ 'ਚ ਹੀ ਲਾ ਦੇਣੀਆ ਚਾਹੀਦੀਆਂ ਹਨ ਕਿਉਂਕਿ ਬੱਚਾ ਉਦੋਂ ਛੋਟੀ ਉਮਰ 'ਚ ਹੁੰਦਾ ਅਤੇ ਉਹਨੂੰ ਨਵੀਆਂ ਨਵੀਆਂ ਚੀਜ਼ਾਂ ਸਿੱਖਣ 'ਚ ਬਹੁਤ ਇੰਟਰਸਟ ਹੁੰਦਾ ਨਾ ਉਹਨੂੰ ਹੁੰਦਾ ਕਿ ਮੈਂ ਨਵਾਂ ਨਵਾਂ ਕੁਛ ਸਿੱਖਾ ਉਹਨੂੰ ਉੱਥੇ ਰੰਗਾਂ ਨਾਲ ਮੋਹ ਪੈਂਦਾ ਉਹਨੂੰ ਪਤਾ ਲੱਗਦਾ ਕਿਹੜਾ ਰੰਗ ਕਿਵੇਂ ਹੈ ਕਿਹੜਾ ਰੰਗ ਕਿਵੇਂ ਹੈ ਪਰ ਸਾਨੂੰ ਡਰਾਇੰਗ ਆ ਜੋ ਉਹ ਨੌਵੀਂ ਦਸਵੀਂ ਕਲਾਸ 'ਚ ਲਾਈ ਸੀ ਅਤੇ ਸਾਨੂੰ ਮਤਲਬ ਉਸ ਦੀ ਇੰਨੀ ਨਹੀਂ ਸਮਝ ਸੀ ਅਤੇ ਇਸ ਲਈ ਅਸੀਂ ਵੱਡੇ ਹੋ ਕੇ ਵੀ ਉਸ ਚੰਗੀ ਤਰ੍ਹਾਂ ਡਰਾਇੰਗ ਨਹੀਂ ਕਰ ਸਕਦੇ ਪਰ ਜਦੋਂ ਆਪਾਂ ਛੋਟੀਆਂ ਕਲਾਸਾਂ 'ਚ ਨਰਸਰੀ 'ਚ ਹੀ ਬੱਚੇ ਨੂੰ ਰੰਗਾ ਬਾਰੇ ਦੱਸਾਂਗੇ ਉਹਨੂੰ ਪੇਂਟਿੰਗ ਬਣਾਉਣ ਬਾਰੇ ਦੱਸਾਂਗੇ ਤਾਂ ਉਹ ਵੱਡਾ ਹੋ ਕੇ ਉਸ ਚੀਜ਼ 'ਚ ਨਿਪੁੰਨ ਬਣ ਜਾਵੇਗਾ ਕਿਉਂ ਉਹਨੂੰ ਡਰਾਇੰਗ ਕਰਨੀ ਬਹੁਤ ਮਤਲਬ ਉਹਦਾ ਇੰਟਰਸਟ ਬਣੇਗਾ ਉਹ ਚੰਗੀ ਤਰ੍ਹਾਂ ਡਰਾਇੰਗ ਕਰ ਸਕੇਗਾ ਪਰ ਉਹਨੂੰ ਜਦੋਂ ਰੰਗਾਂ ਦੀ ਸਮਝ ਨਹੀਂ ਹੋਊਗੀ ਉਹ ਵੱਡੀ ਉਮਰ 'ਚ ਜਾ ਕੇ ਸਿੱਖੂਗਾ ਤਾਂ ਉਹਦਾ ਸ਼ਾਇਦ ਇੰਨਾ ਇੰਟਰਸਟ ਨਾ ਬਣੇ ਪਰ ਜਦੋਂ ਆਪਾਂ ਛੋਟੇ ਹੁੰਦੇ ਹੀ ਬੱਚਿਆਂ ਨੂੰ ਡਰਾਇੰਗ ਨਾਲ ਜੋੜ ਦਿੰਦੇ ਇਹੋ ਜਿਹੀਆਂ ਕਲਾਵਾਂ ਨਾਲ ਜੋੜ ਦਿੰਦੇ ਹਾਂ ਉਹਦੇ 'ਚ ਸਹਿਣਸ਼ੀਲਤਾ ਆਉਂਦੀ ਹੈ ਉਹ ਨੇਚਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿਹੜੇ ਰੰਗ ਦਾ ਕੀ ਮਤਲਬ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਦੇਖ ਸਕਦੇ ਹਾਂ ਜੋ ਡਰਾਇੰਗ ਹੈ ਉਹ ਬੰਦੇ ਦੇ ਜੋ ਮਨੋਭਾਵ ਹੈ ਉਹਨਾਂ ਨੂੰ ਵੀ ਵਿਅਕਤ ਕਰਦੀ ਹੈ ਬਹੁਤ ਸਾਰੇ ਇਹੋ ਜਿਹੇ ਮਨੋਭਾਵ ਆ ਜੋ ਅਸੀਂ ਡਰੈਗ ਰਾਹੀਂ ਦੱਸ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਸਿਰਫ ਦੇਖ ਕੇ ਹੀ ਤਸਵੀਰਾਂ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਜੋ ਡਰਾਇੰਗ ਹੈ ਇਹ ਬਹੁਤ ਹੀ ਸੂਖਮ ਕਲਾ ਹੈ ਅਤੇ ਇਸਨੂੰ ਸ਼ੁਰੂਆਤੀ ਦੌਰ 'ਤੇ ਹੀ ਲਾ ਦੇਣੀ ਚਾਹੀਦੀ ਹੈ ਸਕੂਲਾਂ 'ਚ ਨਰਸਰੀ ਐਲ ਕੇ ਜੀ ਯੂ ਕੇ ਜੀ ਤੋਂ ਹੀ ਮਤਲਬ ਰੰਗਾਂ ਬਾਰੇ ਡਰਾਇੰਗ ਬਾਰੇ ਪੇਂਟਿੰਗ ਕਰਨ ਬਾਰੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ